ਹੈਲੋ ਹਾਏ ਬੜੀਆ ਆਪ ਬਤਾਓ ਓ ਨਹੀਂ ਯਾਰ ਐਚੁਲੀ ਮੇਰਾ ਟਾਈਮ ਹੀ ਨਹੀਂ ਲੱਗਾ ਮੈਂ ਬਹੁਤ ਬਿਜ਼ੀ ਸੀ ਕਿਉਂਕਿ ਫਿਜਿਕਸ ਦੇ ਇਗਜਾਮ ਦੀ ਤਿਆਰੀ ਕਰ ਰਹੇ ਨੇ ਮੈਂ ਹਾਂਜੀ ਹਾਂਜੀ ਹਾਂਜੀ ਹਾਂਜੀ ਇਹਦੇ ਨਾਲ ਆਪਣੀ ਟਾਈਮ ਵੀ ਹੋ ਜੇਗੀ ਤੇ ਆਪਾਂ ਨੂੰ ਆਇਡਿਯਾ ਵੀ ਬੈਸਟ ਮਿਲ ਜਾਏਗਾ ਹਾਂਜੀ ਹਾਂਜੀ ਹਾਂ ਆਈ ਥਿੰਕ ਉਹ ਬੈਸਟ ਪਲੇਸ ਹੈ ਕਿਉਂਕਿ ਉਹਦੇ ਉਹਦੀ ਹਿਸਟਰੀ ਵੀ ਆਪਾਂ ਨੂੰ ਆਈਡੈਂਟੀਫਾਈ ਕਰਨ 'ਚ ਕੋਈ ਪ੍ਰੋਬਲਮ ਨਹੀਂ ਹੋਏਗੀ ਕਿਉਂਕਿ ਉੱਥੇ ਇਹਦੇ ਵਿੱਚ ਆਪਾਂ ਨੂੰ ਸਾਰਾ ਕੁਛ ਮਿਲ ਜਾਏਗਾ ਅਤੇ ਉਹ ਆਪਣੇ ਲਈ ਜ਼ਿਆਦਾ ਡਿਫਿਕਲਟੀ ਨਹੀਂ ਹੋਏਗਾ ਹਾਂਜੀ ਹਾਂਜੀ ਹਾਂ ਹਾਂ ਹਾਂਜੀ ਔਰ ਮੈਂ ਇੱਕ ਗੱਲ ਹੋਰ ਇੱਥੇ ਸੁਣੀ ਆ ਕਿ ਜਿਹੜਾ ਇਹ ਵਾਲਾ ਮਿਊਜੀਅਮ ਆ ਉਹਦੇ ਵਿੱਚ ਵਾਈਫਾਈ ਫਰੀ ਅਤੇ ਸਿਟਿੰਗ ਏਰੀਆ ਵੀ ਬਹੁਤ ਵਧੀਆ ਹੈ ਅਤੇ ਇੱਕ ਰਿਲੈਕਸੇਸ਼ਨ ਪਲੇਜ਼ ਹੈ ਉਹ ਹਾਂਜੀ ਬਟ ਆਈ ਥਿੰਕ ਇਹਦੇ ਵਿੱਚ ਆਪਾਂ ਥੋੜ੍ਹਾ ਜਿਹਾ ਅਗਰ ਆਪਾਂ ਸਾ ਗੁਰਦੁਆਰਾ ਸਾਰਾ ਗੜ੍ਹੀ 'ਚ ਕਰ ਰਹੇ ਹਾਂ ਅਤੇ ਜੇ ਆਪਾਂ ਨੈਕਸਟ ਵੀ ਗੁਰਦੁਆਰਾ ਪਲੇਸ ਕਰਾਂਗੇ ਤਾਂ ਫਿਰ ਉਹ ਸਾਰਾ ਇਸ ਤੋਂ ਆਈ ਥਿੰਕ ਬੈਟਰ ਓਪਸ਼ਨ ਆ ਹੁਸੈਨੀ ਵਾਲਾ ਬੈਡ ਬੋਡਰ ਹਾਂਜੀ ਹਾਂ ਇਹ ਗੁੱਡ ਆਈਡੀਆ ਹੈ ਕਿਉਂਕਿ ਇਹਦੇ ਨਾਲ ਆਪਣੀਆਂ ਤਿੰਨੋ ਟਰਡੀਸ਼ਨਲ ਹਿਸਟੋਰੀਕਲ ਪਲੇਸਿਸ ਕਵਰ ਹੋ ਜਾਣਗੀਆਂ ਆਪਾਂ ਨੂੰ ਕੁਲੈਕਟਿੰਗ ਮਟੀਰੀਅਲ ਵੀ ਮਿਲ ਜਾਉਗਾ ਕੁਲੈਕਟ ਕਰਨ ਲਈ ਕਾਫੀ ਸਾਰਾ ਮਟੀਰੀਅਲ ਵੀ ਮਿਲਜੇਗਾ ਅਤੇ ਆਪਣੀ ਅਸਾਈਮੈਂਟ ਲਈ ਇਹ ਇਫੈਕਟਿਵ ਵੀ ਹੋਏਗਾ

ਹਾਂਜੀ

ਔਰ ਇਕ ਇਹ ਵੀ ਬੈਸਟ ਓਪਚੁਨਟੀ ਹੈ ਕਿ ਆਪਾਂ ਇਵਨਿੰਗ ਜਿਹੜੀ ਪਰੇਡ ਆ ਉਹ ਵਿਜ਼ਿਟ ਕਰ ਸਕਦੇ ਹਾਂ ਹਾਂਜੀ ਹਾਂਜੀ ਔਰ ਇਹ ਇਸ ਤੋਂ ਵਧੀਆ ਇੱਕ ਡੈਡੀਕੇਸ਼ਨ ਟ੍ਰਿਪ ਰਹਿ ਜਾਏਗਾ ਕਿਉਂਕਿ ਆਪਾਂ ਜੇ ਈਵਨਿੰਗ ਦੇ ਵਿੱਚ ਪਰੇਡ ਬੱਚੇ ਦੇਖਦੇ ਆ ਅਤੇ ਉਹ ਉਹਨਾਂ ਲਈ ਇੱਕ ਯਾਦਗਾਰ ਪਲ ਰਹਿ ਜਾਏਗਾ ਹਾਂਜੀ ਹਾਂਜੀ ਡਨ ਹਾਂਜੀ ਡਨ ਓਕੇ ਥੈਂਕ ਯੂ ਓਕੇ ਜੀ